ਪੇਂਟਿੰਗ ਡਰਾਇੰਗ ਮੂਰਤੀ ਫੋਟੋਗ੍ਰਾਫੀ ਗਰਾਫਿਕ ਡਿਜਾਇਨ ਮੈਕਿੰਗ ਸੰਗੀਤ ਡਾਂਸ ਥੀਏਟਰ ਸੰਗੀਤ ਥੀਏਟਰ ਸੁਧਾਰ ਨਾਟਕ ਲਿਖਣਾ ਸਟੇਜ ਡਿਜ਼ਾਇਨ ਰੋਸ਼ਨੀ ਅਤੇ ਧੁੰਨੀ ਤਨਕਾਲੋਜੀ ਐਲੀਮੈਂਸ਼ਨ ਫਿਲਮ ਨਿਰਮਾਣ ਵੀਡੀਓ ਸੰਪਾਦਨ ਗੇਮ ਡਿਜ਼ਾਇਨ ਡਿਜੀਟਲ ਮੀਡੀਆ ਮਿੱਟੀ ਦੇ ਬਰਤਨ ਵਰਸਾਵਿਕ ਟੈਕਸਟਾਈਲ ਲੱਕੜ ਦਾ ਕੰਮ ਗਹਿਣੇ ਬਣਾਉਣਾ ਕਲਾ ਇਤਿਹਾਸ ਕਲਾ ਦੇ ਪ੍ਰਸ਼ੰਸਾ ਰਚਨਾਤਮਕ ਲੇਖਣ ਫੈਸ਼ਨ ਡਿਜਾਇਨ